ਅੰਮ੍ਰਿਤਾ ਪ੍ਰੀਤਮ ਮੇਰੀ ਪਸੰਦੀਦਾ ਲੇਖਿਕਾ ਹੈ ਉਨ੍ਹਾਂ ਨੂੰ ਪਸੰਦ ਕਰਨ ਦਾ ਮੇਰੇ ਬਹੁਤ ਸਾਰੇ ਕਾਰਨ ਹਨ ਜਿਨ੍ਹਾਂ ਵਿੱਚੋਂ ਇੱਕ ਕਾਰਨ ਉਨ੍ਹਾਂ ਦਾ ਇਮਤੋਜ਼ ਦੇ ਨਾਲ ਪਿਆਰ ਭਰਿਆ ਵਿਵਹਾਰ ਅਤੇ ਉਨ੍ਹਾਂ ਦੇ ਨਾਲ ਬਿਤਾਈ ਹੋਈ ਆਪਣੀ ਸਾਰੀ ਉਮਰ ਹੈ ਇਮਤੋਜ਼ ਜੋ ਕਿ ਉਨ੍ਹਾਂ ਦੇ ਨਾਲ ਵਿਆਹ ਦੇ ਬੰਧਨ ਵਿੱਚ ਵੀ ਨਹੀਂ ਬੱਝੇ ਸਨ ਫਿਰ ਵੀ ਉਹ ਦੋਨੋਂ ਇਕੱਠੇ ਰਹਿੰਦੇ ਸਨ ਉਹ ਇਮਤੋਜ਼ ਦਾ ਅੰਮ੍ਰਿਤਾ ਪ੍ਰੀਤਮ ਦੇ ਲਈ ਪਿਆਰ ਅਤੇ ਅੰਮ੍ਰਿਤਾ ਪ੍ਰੀਤਮ ਦਾ ਇਮਤੋਜ਼ ਦੇ ਲਈ ਜੋ ਸੋਚ ਸੀ ਉਹ ਇੱਕ ਬਾਕਮਾਲ ਜਿਹੜੀ ਪਿਆਰ ਭਰੀ ਗਾਥਾ ਨੂੰ ਬਿਆਨ ਕਰਦੀ ਹੈ